ਜਾਣੀ ਕਿ ਮੈਨੂੰ ਕਾਫ਼ੀ ਸ਼ੌਂਕ ਹੈ ਰੌਕ ਕਲਾਈਮਬਿੰਗ ਦਾ ਅਤੇ ਮੈਂ ਕਰਦਾ ਵੀ ਰਹਿੰਦਾ ਹਾਂ ਮੇਰੇ ਇੱਕ ਦੋ ਯਾਰ ਦੋਸਤ ਨੇ ਜਿਵੇਂ ਕਿ ਨਾ ਮੈਂ ਅਤੇ ਡੂਗਾ ਹੈ ਇਹਦੇ ਨਾਲ਼ ਮੈਂ ਜਾਂਦਾ ਰਹਿੰਦਾ ਜ਼ਿਆਦਾਤਰ ਅਸੀਂ ਮਿਰਜ਼ਾਪੁਰ ਦੇ ਵਿੱਚ ਰੌਕ ਕਲਾਈਮਬਿੰਗ ਕਰਦੇ ਹਾਂ ਉੱਥੇ ਬਹੁਤ ਸਾਰੀਆਂ ਚੱਟਾਨਾਂ ਹੈਗੀਆਂ ਜਿਹਨਾਂ ਦੇ ਉੱਤੇ ਅਸੀਂ ਚੜ੍ਹਦੇ ਉੱਤਰਦੇ ਰਹਿੰਦੇ ਹਾਂ ਅਤੇ ਇੰਜ਼ੁਆਏ ਕਰਦੇ ਹਾਂ ਆਪਣੀ ਜ਼ਿੰਦਗੀ ਆਨੰਦ ਮਾਣੀ ਦਾ ਪੂਰਾ ਅਤੇ ਅਸਲ ਦੇ ਵਿੱਚ ਮੈਨੂੰ ਮੌਕਾ ਮਿਲਿਆ ਮੇਰੇ ਕੋਲਜ ਦੇ ਵਿੱਚ ਰੌਕ ਕਲਾਈਮਬਿੰਗ ਬਾਰੇ ਸਿੱਖਣ ਦਾ ਉੱਥੇ ਮੈਨੂੰ ਇੱਕ ਬੰਦਾ ਮਿਲਿਆ ਜਿਹਨੂੰ ਇਸ ਚੀਜ਼ ਬਾਰੇ ਕਾਫ਼ੀ ਜਾਣਕਾਰੀ ਥੀ ਅਤੇ ਸ਼ੌਂਕ ਵੀ ਰੱਖਦਾ ਤਾ ਅਤੇ ਉਹਨੇ ਜਾਣੀ ਕਿ ਸੰਸਾਰ ਦੇ ਵਿੱਚ ਭਾਰਤ ਤੋਂ ਇਲਾਵਾ ਹੋਰ ਕਈ ਦੇਸ਼ਾਂ ਵਿੱਚ ਜਾ ਕੇ ਵੀ ਰੌਕ ਕਲਾਈਮਬਿੰਗ ਕੀਤੀ ਹੈ ਅਤੇ ਮੈਨੂੰ ਉਹ ਤੋਂ ਸਿੱਖਣ ਦਾ ਮੌਕਾ ਮਿਲਿਆ ਅਤੇ ਚਲੋ ਮੈਂ ਸਿੱਖਿਆ ਵੀ ਅਤੇ ਮੈਨੂੰ ਬੜਾ ਆਨੰਦ ਆਇਆ ਅਤੇ ਹੁਣ ਵੀ ਜਾਣੀ ਕਿ ਅਸੀਂ ਜਦੋਂ ਕਿਤੇ ਜ਼ਿਰਕਪੁਰ ਸਾਇਡ ਜਾਈ ਦਾ ਉੱਥੇ ਡੀਕੈਥਲਨ ਮੌਲ ਹੈ ਅਤੇ ਉੱਥੋਂ ਅਸੀਂ ਜ਼ਿਆਦਾਤਰ ਪ੍ਰੈਫਰ ਕਰਦੇ ਹਾਂ ਵੀ ਸਮਾਨ ਖਰੀਦਿਆ ਜਾਵੇ ਉੱਥੋਂ ਸਾਨੂੰ ਹਰੇਕ ਨਵੇਂ ਤੋਂ ਨਵਾਂ ਕਲਾਈਮਬਿੰਗ ਰਿਲੇਟਿਡ ਹਰੇਕ ਚੀਜ਼ ਮਿਲ ਜਾਂਦੀ ਹੈ ਚਾਹੇ ਕੋਈ ਫੇਰ ਉਹ ਹੁੱਕ ਹੋਵੇ ਚਾਹੇ ਕੋਈ ਨਵੀਂ ਵਰਾਇਟੀ ਦੀ ਰੱਸੀ ਹੋਵੇ ਜਾਂ ਹੋਰ ਕੋਈ ਵੀ ਮੈਟੀਰੀਅਲ ਹੋਵੇ ਜਿਵੇਂ ਕਿ ਕੋਈ ਗਾਅਰਡ ਵਗੈਰਾ ਹੋਵੇ ਕੁਝ ਵੀ ਹੈ ਉਹ ਸਭ ਕੁਝ ਸਾਨੂੰ ਉੱਥੋਂ ਮਿਲ ਜਾਂਦਾ ਸੋ ਇਦਾਂ ਕਰਕੇ ਉੱਥੋਂ ਅਸੀਂ ਨਵੇਂ ਤੋਂ ਨਵਾਂ ਜਿਹੜਾ ਵੀ ਇਕਯੁਪਮੈਂਟ ਚਾਹੀਦਾ ਹੁੰਦਾ ਅਸੀਂ ਉੱਥੋਂ ਲੈ ਲੈਂਦੇ ਹਾਂ ਬਾਕੀ ਹੋਰ ਮੈਨੂੰ ਕਿਸੇ ਕੋਚ ਨੂੰ ਮਿਲਣ ਦੀ ਲੋੜ ਨਹੀਂ ਪਈ ਕਿਉਂਕਿ ਬੰਦਾ ਇੰਨਾ ਕੁ ਪਰਫੈਕਟ ਸੀ ਇਸ ਚੀਜ਼ ਦੇ ਵਿੱਚ ਕਿ ਬਸ ਉਹਨੇ ਸਭ ਕੁਛ ਸਿਖਾ ਦਿੱਤਾ ਜਾਣੀ ਕਿ ਮੈਨੂੰ ਉਹ ਅੱਜ ਦੀ ਤਰੀਕ 'ਚ ਮੇਰਾ ਚੰਗਾ ਮਿੱਤਰ ਹੈ ਅਤੇ ਅਸੀਂ ਅਕਸਰ ਰੌਕ ਕਲਾਈਮਬਿੰਗ ਕਰਦੇ ਰਹਿੰਦੇ ਹਾਂ ਸੋ ਹੁਣ ਸਾਡਾ ਅੱਗੇ ਪਲੈਨ ਹੈਗਾ ਹੈ ਵੀ ਹੁਣ ਇੰਡੀਆ ਤੋਂ ਬਾਹਰ ਕਿਸੇ ਕੰਟਰੀ 'ਚ ਜਾ ਕੇ ਰੌਕ ਕਲਾਈਮਬਿੰਗ ਕਰਕੇ ਆਉਣੀ